ਜਿਹੜੀਆਂ ਪਿੱਛੋਂ ਟੈਬ ਜਿਹੜੀਆਂ ਪਾਈਪਾਂ ਆ ਰਹੀਆਂ ਨੇ ਜਾਂ ਤਾਂ ਉਹਦੇ ਅੰਦਰ ਕਾਫੀ ਜ਼ਿਆਦਾ' ਜਿਹੜਾ ਕਹਿ ਸਕਦੇ ਗੰਦਗੀ ਭਰੀ ਹੈ ਜਾਂ ਪਿੱਛੋਂ ਸਪਲਾਈ ਗਲਤ ਆ ਰਹੀ ਹੈ ਜਿਹੜੇ ਪਾਣੀ ਦੀ ਉਹ ਨੂੰ ਚੈੱਕ ਕਰਨ ਦੀ ਮੈਂ ਰਿਕੁਐਸਟ ਕੀਤੀ ਹੈ ਅਤੇ ਉਹ ਇਮੀਡੀਟਲੀ ਉਹਨਾਂ ਦੇ ਮੇਰੀ ਕੰਪਲੇਂਟ ਰਜਿਸਟਰ ਕਰ ਲਈ ਹੈ ਅਤੇ ਜਲਦ ਤੋਂ ਜਲਦ ਮੈਨੂੰ ਆਸ਼ਵਾਸਨ ਦੇਣ ਦੀ ਉਹਨਾਂ ਨੇ ਸ਼ੋਰ ਸੋਰਟੀ ਦਿੱਤੀ ਹੈ